ਪੱਚੀ ਸੱਤ ਦੋ ਹਜ਼ਾਰ ਛੇ ਛੇ ਅੱਠ ਦੋ ਹਜ਼ਾਰ ਸੱਤ ਸਤਾਈ ਅੱਠ ਦੋ ਹਜ਼ਾਰ ਇੱਕ ਉਨੱਤੀ ਤਿੰਨ ਦੋ ਹਜ਼ਾਰ ਦੋ ਪੰਦਰਾਂ ਚਾਰ ਦੋ ਹਜ਼ਾਰ ਸਤਾਰਾਂ